ਹੈਲੋ ਫਲਿੱਪਕਾਰਟ ਮੈਂ ਤੁਹਾਡੇ ਤੋਂ ਚਾਰ ਦਿਨ ਪਹਿਲਾਂ ਇੱਕ ਏ ਸੀ ਖਰੀਦਦਾਰੀ ਕੀਤੀ ਸੀ ਕ ਜੋ ਕਿ ਮੈਨੂੰ ਸਮੇਂ ਸਿਰ ਉਪਲਬਧ ਕਰਵਾ ਦਿੱਤਾ ਗਿਆ ਜੋ ਵੀ ਤੁਹਾਡਾ ਲੜਕਾ ਡਿਲੀਵਰ ਕਰਨ ਆਇਆ ਸੀ ਉਸ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਸੀ ਅਤੇ ਉਹ ਟਾਇਮ ਦੇ ਨਾਲ ਸਾਰਾ ਫਿੱਟ ਕਰਕੇ ਗਿਆ ਏ ਸੀ ਅਤੇ ਉਹ ਏ ਸੀ ਦੀ ਪਰਫੋਰਮੈਂਸ ਵੀ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ